ਮੈਂ ਆਪਣੀ ਚੱਲ ਰਹੀ ਰੂਟੀਨ ਵਿੱਚ ਤਾਕਤ ਅਤੇ ਲਚਕਤਾ ਸਿਖਲਾਈ ਨੂੰ ਇਸ ਪ੍ਰਕਾਰ ਸ਼ਾਮਿਲ ਕਰਦਾ ਹਾਂ ਜਿਵੇਂ ਕਿ ਪੰਜ ਵਜੇ ਸਵੇਰੇ ਉੱਠਦਾ ਹਾਂ ਅਤੇ ਗਰਮ ਪਾਣੀ ਪੀ ਕੇ ਸਾਈਕਲ ਫੜ ਕੇ ਸਵੇਰੇ ਰੋਜ਼ ਦਸ ਕਿਲੋਮੀਟਰ ਸਾਈਕਲਿੰਗ ਕਰਨੀ ਉਸ ਤੋਂ ਬਾਅਦ ਗਰਾਊਂਡ ਵਿੱਚ ਰਨਿੰਗ ਕਰਨੀ ਅਤੇ ਉਸ ਤੋਂ ਬਾਅਦ ਸੈਕਲਿੰਗ ਕਰਕੇ ਹੀ ਘਰ ਆਉਣਾ ਤਾਂ ਉਸ ਤੋਂ ਬਾਅਦ ਡਾਇਟ ਵਿੱਚ ਵਧੀਆ ਵਧੀਆ ਤਰੀਕੇ ਦਾ ਖਾਣਾ ਖਾਣਾ ਜਿਵੇਂ ਚਣੇ ਗੁੜ ਹਰੀ ਸਬਜ਼ੀਆਂ ਫ਼ਲ ਫਰੂਟ ਕੇਲਾ ਦੁੱਧ ਦੇਸੀ ਘਿਓ ਵਗੈਰਾ ਉਸ ਤੋਂ ਬਾਅਦ ਕੋਲਜ ਜਾਣਾ ਮੈਂ ਕੋਲਜ ਵਿੱਚ ਵੀ ਗੇਮ ਐਕਟੀਵਿਟੀ ਚ' ਵਿੱਚ ਪਾਰਟੀਸਪੇਟ ਕੀਤਾ ਹੈ ਜਿਸ ਵਿੱਚ ਮੈਂ ਫੁੱਟਬੋਲ ਗੇਮ ਰੱਖੀ ਹੈ ਜਿਸ ਨਾਲ ਮੈਨੂੰ ਰਨਿੰਗ ਵਿੱਚ ਹੈਲਪ ਮਿਲਦੀ ਹੈ ਵਗੈਰਾ ਸਟੈਮੀਨਾ ਵੱਧਦਾ ਹੈ ਕੋਲਜ ਤੋਂ ਬਾਅਦ ਮੈਂ ਜਿੰਮ ਜਾਂਦਾ ਹਾਂ ਜਿੰਮ ਵਿੱਚ ਮੈਨੂੰ ਆਪਣੇ ਸਰੀਰ ਦੀ ਤਾਕਤ ਵਗੈਰਾ ਫੀਲ ਹੁੰਦੀ ਹੈ ਜਿਸ ਨਾਲ ਮੇਰਾ ਸਰੀਰ ਐਕਟਿਵ ਰਹਿੰਦਾ ਅਤੇ ਤੰਦਰੁਸਤੀ ਫੀਲ ਹੁੰਦੀ ਹੈ ਇਸ ਪ੍ਰਕਾਰ ਨਾਲ ਮੈਂ ਆਪਣੀ ਲਾਈਫ ਵਿੱਚ ਰੂਟੀਨ ਲਾਈਫ ਦੀ ਰੂਟੀਨ ਵਿੱਚ ਸ਼ਾਮਿਲ ਕੀਤਾ ਹੈ